ਮੈਂ ਅਕਸਰ ਹੀ ਅਕਸਰ ਹੀ ਟੂਰ 'ਤੇ ਜਾਂਦਾ ਰਹਿੰਦਾ ਹਾਂ ਅਤੇ ਮੇਰੀਆਂ ਟੂਰ 'ਤੇ ਮਨ ਪਸੰਦ ਜਗ੍ਹਾ ਮੇਰੀਆਂ ਬਹੁਤ ਸਾਰੀਆਂ ਹਨ ਜਿ ਜਿੱਥੇ ਮੈਂ ਘੁੰਮਣ ਜਾਂਦਾ ਰਹਿੰਦਾ ਹਾਂ ਮੈਂ ਸ਼ਿਮਲੇ ਵੀ ਘੁੰਮ ਕੇ ਆਇਆ ਹਾਂ ਮੈਂ ਜੰਮੂ ਕਸ਼ਮੀਰ ਵੀ ਦੇਖ ਕੇ ਆਇਆ ਉਹ ਵੀ ਬਹੁਤ ਸੋਹਣੀ ਜਗ੍ਹਾ ਹੈ ਦੇਖਣ ਵਾਲੀ ਦ੍ਰਿਸ਼ ਹੈ ਉੱਥੇ ਅਤੇ ਇਸ ਤੋਂ ਇਲਾਵਾ ਅਸੀਂ ਹੋਰ ਵੀ ਆਪਣੇ ਜੋ ਇਲਾਕੇ ਦੇ ਲਾਗੇ ਲਾਗੇ ਸਥਾਨ ਹਨ ਉਹਨਾਂ ਉਹ ਵੀ ਅਸੀਂ ਵੇਖਦੇ ਹਾਂ ਅਤੇ ਮਤਲਬ ਇਹ ਵੀ ਘੁੰਮਣ ਤੋਂ ਬਾਅਦ ਅਸੀਂ ਜਲ੍ਹਿਆਂਵਾਲਾ ਬਾਗ਼ ਵੀ ਦੇਖਦੇ ਹਾਂ ਜਿੱਥੇ ਸਾਨੂੰ ਆਪਣੇ ਇਤਿਹਾਸ ਬਾਰੇ ਵੀ ਪਤਾ ਲੱਗਦਾ ਹੈ ਭਈ ਸਾਡਾ ਪੁਰਾਣਾ ਵਿਰਸਾ ਕੀ ਸੀ ਅਤੇ ਸਾਨੂੰ ਕਿਸ ਤਰ੍ਹਾਂ ਸਾਡੇ 'ਤੇ ਜ਼ੁਲਮ ਹੋਏ ਹਨ ਇਸ ਬਾਰੇ ਲਈ ਅਸੀਂ ਨੌਲਜ਼ ਲੈਂਦੇ ਰਹਿੰਦੇ ਹਾਂ ਅਤੇ ਇਸ ਤਰ੍ਹਾਂ ਮਨ ਪਸੰਦ ਜਗ੍ਹਾ 'ਤੇ ਜਾ ਕੇ ਵੀ ਅਸੀਂ ਦੇਖਦੇ ਰਹਿੰਦੇ ਹਾਂ ਅਸੀਂ ਮਤਲਬ ਅਟਾਰੀ ਸਾਹਿਬ ਜੋ ਸਾਡਾ ਤਿਰੰਗਾ ਝੰਡਾ ਚੜ੍ਹਦਾ ਹੈ ਉੱਥੇ ਵੀ ਅਸੀਂ ਦੇਖਣ ਜਾਂਦੇ ਹਾਂ ਵਾਘਾ ਬਾਰਡਰ ਉਹ ਵੀ ਸਾਨੂੰ ਪਸੰਦ ਦੀ ਜਗ੍ਹਾ ਲੱਗਦੀ ਹੈ